ਤੈਕਨੋਲਜੀ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਆ ਗਈ ਤੈਕਨੋਲਜੀ ਅੱਜ ਕੱਲ੍ਹ ਬਹੁਤ ਤੈਕਨੋਲਜੀ ਕੀਤੀ ਹੈ ਜਿਵੇਂ ਖੇਤੀਬਾੜੀ ਵਿੱਚ ਪਹਿਲਾਂ ਲੋਕ ਹੱਥਾਂ ਨਾਲ ਖੇਤੀ ਕਰਦੇ ਸੀ ਅੱਜ ਕੱਲ੍ਹ ਮਸ਼ੀਨਾਂ ਨਾਲ ਉਹੀ ਦਸ ਬੰਦਿਆਂ ਦਾ ਕੰਮ ਇੱਕ ਮਸ਼ੀਨ ਕਰ ਦਿੰਦੀ ਹੈ ਇਹ ਵੀ ਇੱਕ ਤੈਕਨੋਲਜੀ ਹੈ ਅਤੇ ਟੈਲੀਫੋਨ ਦੀ ਟੈਕਨੋਲਜੀ ਲਾ ਲਓ ਜਿਵੇਂ ਲੋਕ ਪਹਿਲਾਂ ਚਿੱਠੀਆਂ ਵਗੈਰਾ ਲਿਖਦੇ ਸੀ ਹੁਣ ਟੈਲੀਫੋਨ 'ਤੇ ਗੱਲ ਕਰਕੇ ਆਪਦਾ ਸੰਚਾਰ ਭੇਜ ਦਿੰਦੇ ਆ ਤੈਕਨੋਲਜੀ ਹੁਣ ਜਿਵੇਂ ਪਹਿਲਾਂ ਅਸੀਂ ਟੂ ਜੀ ਸੀ ਫਾਇਵ ਜੀ ਆ ਗਿਆ ਹੁਣ ਪਹਿਲਾਂ ਫਿਰ ਆਇਆ ਫੌਰ ਜੀ ਆਇਆ ਅਤੇ ਹੁਣ ਫਾਇਵ ਜੀ ਆ ਗਿਆ ਇਹ ਵੀ ਇੱਕ ਟੈਕਨੋਲਜੀ ਹੈ ਅਤੇ ਆਹ ਹੋਰ ਜਿਹੜੇ ਸਮਾਨ ਚਲਾ ਲਓ ਲੋਕ ਦੂਰ ਦੁਰਾਡੇ ਬੈਠੇ ਜਿਵੇਂ ਮਰਜ਼ੀ ਆਪਦਾ ਸਮਾਨ ਭੇਜ ਦਿੰਦੇ ਹੈ ਇੱਥੋਂ ਬੈਠੇ ਭਲਾ ਲੰਦਨ 'ਚ ਭੇਜ ਦਓ ਸਮਾਨ ਨੂੰ ਆਊਟ ਆਫ ਕੰਟਰੀਆਂ ਭੇਜ ਦਓ ਇਹ ਵੀ ਇੱਕ ਟੈਕਨੋਲਜੀ ਟੈਕਨੋਲਜੀ ਹੈ ਟੈਕਨੋਲਜੀ ਦੇ ਪੱਖੋਂ ਜਿਹੜਾ ਹੈ ਮਹੱਤਵ ਚੁਤਾਲੀਵੇਂ ਨੰਬਰ 'ਤੇ ਆ ਹੁਣ ਅਤੇ ਚੁਤਾਲੀਵੇਂ ਨੰਬਰ 'ਤੇ ਆ ਅਤੇ ਹੋਰ ਵੀ ਬਹੁਤ ਤਰ੍ਹਾਂ ਜਿਵੇਂ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਕੰਪਨੀਆਂ ਜਿਵੇਂ ਫਾਰੈਂਸੀ ਕੰਪਨੀਆਂ ਹੋਰ ਖੇਤੀਬਾੜੀ ਦਾ ਕੰਮ ਕਰਨੀਆਂ ਜਾਂ ਅਤੇ ਬਿਜਲੀ ਵਗੈਰਾ ਇਲੈਕਟਰੋਨਿਕ ਪ੍ਰੋਡਕਟ ਵਗੈਰਾ ਦੀਆਂ ਕੰਪਨੀਆਂ ਇਹ ਸਾਰੀਆਂ ਇਹਨਾਂ ਟੈਕਨੋਲਜੀ ਪੈਦਾ ਕੀਤੀ ਹੋਈ ਟੈਕਨੋਲਜੀ ਦੁਆਰਾ ਹੀ ਹੈ ਖੇਤਰ ਦੇ ਪੱਖੋਂ ਵੀ ਐਨਾ ਕੁਛ ਆ ਗਿਆ ਹੈ ਖੇਤੀਬਾੜੀ ਦਾ ਕੰਮ ਕੀਤਾ ਗਿਆ ਹੈ ਉਹ ਵੀ ਟੈਕਨੋਲਜੀਆਂ ਦੁਆਰਾ ਕੀਤਾ ਗਿਆ ਹੈ